ਹਰ ਵਿੱਚ ਇੱਕ ਕਲਾ ਹੁੰਦੀ ਹੈ ਇਹ ਕਲਾ ਪਰਮਾਤਮਾ ਵੱਲੋਂ ਪਾਈ ਜਾਂਦੀ ਹੈ ਹਰ ਇੱਕ ਦੀ ਕਲਾ ਵੱਖੋ ਵੱਖਰੀ ਹੈ ਕੋਈ ਕਿਸੇ ਕਲਾ ਵਿੱਚ ਮਾਹਿਰ ਹੈ ਅਤੇ ਕੋਈ ਕਿਸੇ ਹੋਰ ਕਲਾ ਵਿੱਚ ਇਸ ਤਰ੍ਹਾ ਐੱਲ ਆਈ ਡਰਾਇੰਗ ਵੀ ਇੱਕ ਕਲਾ ਹੈ ਬਚਪਨ ਵਿੱਚ ਹੀ ਕਈ ਬੱਚੇ ਇਸ ਕਲਾ ਵਿੱਚ ਮਾਹਿਰ ਹੁੰਦੇ ਹਨ ਸਾਡੇ ਸਕੂਲਾਂ ਵਿੱਚ ਇਹ ਡਰਾਇੰਗ ਪੰਜਵੀਂ ਕਲਾਸ ਤੋਂ ਸ਼ੁਰੂ ਕੀਤੀ ਜਾਂਦੀ ਹੈ ਬੱਚੇ ਦੀ ਡਰਾਇੰਗ ਕਲਾ ਨੂੰ ਦੇਖਦੇ ਉਸ ਵਿੱਚ ਉਹਨੂੰ ਮਾਹਿਰ ਕੀਤਾ ਜਾਂਦਾ ਹੈ ਇਸ ਪ੍ਰਕਾਰ ਕਈ ਹੋਰ ਇਸ ਪ੍ਰਕਾਰ ਕਲਾ ਦੀ ਕੋਈ ਉਮਰ ਨਹੀਂ ਹੁੰਦੀ ਡਰਾਇੰਗ ਕਿਸੇ ਵੀ ਉਮਰ ਵਿਚ ਸਿੱਖ ਸਕਦੇ ਹਾਂ ਕਈ ਬੱਚਿਆਂ ਨੂੰ ਬਚਪਨ ਤੋਂ ਹੀ ਡਰਾਇੰਗ ਕਰਨ ਦਾ ਸ਼ੌਕ ਹੁੰਦਾ ਹੈ ਕਈ ਬੱਚੇ ਸ਼ੁਰੂ ਵਿੱਚ ਹੀ ਡਰਾਇੰਗ ਕਰਨਾ ਸਿੱਖ ਜਾਂਦੇ ਹਨ ਔਰ ਥੋੜ੍ਹੇ ਵੱਡੇ ਹੋ ਕੇ ਉਹ ਹੋਰ ਵੀ ਇਸ ਡਰਾਇੰਗ ਕਲਾ ਵਿੱਚ ਮਾਹਿਰ ਹੋ ਜਾਂਦੇ ਹਨ